ਅਤੇ ਜਿੱਦਾਂ ਜਿਹਨੇ ਕੋਈ ਆਰਟ ਆਰਟਸ ਰੱਖਿਆ ਹੁੰਦਾ ਹੈ ਉਹ ਆਰਮੀ ਜਾਂ ਕਿਸੇ ਕੋਈ ਵੀ ਕੰਪਨੀ ਵਗੈਰਾ ਦਾ ਕਾਰੋਬਾਰ ਕਰਦਾ ਹੈ ਅਤੇ ਜਿੰਨੇ ਵੀ ਨੌਕਰੀ ਅੱਜ ਕੱਲ੍ਹ ਦੇ ਨੌਕਰੀ ਵੀ ਬਹੁਤ ਹੀ ਜ਼ਰੂਰੀ ਹੈ ਹਰੇਕ ਖੇਤਰ ਵਿੱਚ ਨੌਕਰੀ ਬਹੁਤ ਹੀ ਜ਼ਿਆਦਾ ਜ਼ਰੂਰੀ ਅਤੇ ਮਹੱਤਵਪੂਰਨ ਹੋ ਗ ਬਣ ਚੁੱਕਿਆ ਹੈ ਅਤੇ ਜਿੰਨੇ ਵੀ ਪਰਿਵਾਰ ਵਿੱਚ ਆਹ ਹੋਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਹਨ ਉਹ ਆਪਣੇ ਮਤਲਬ ਬ ਬੱਚਿਆਂ ਨੂੰ ਅੱਗੇ ਵਧਾਉਣ ਲਈ ਉਹਨਾਂ ਦੀ ਪੜ੍ਹਾਈ ਜਾਰੀ ਰੱਖਣ ਲਈ ਉਹਨਾਂ ਦਾ ਮਦਦ ਕਰਨ